ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਨਾ ਨਵੀਂ ਨਵੀਂ ਪੰਜਾਬ ਵਿੱਚ ਆਈ ਸੀ ਅਤੇ ਮੈਂ ਇਹ ਜਾਣਨ ਦੀ ਬੜੀ ਇੱਛਾ ਰੱਖਦੀ ਆ ਕਿ ਕਿੱਥੇ ਕਿੱਥੇ ਸ਼ੂਟਿੰਗ ਵਗੈਰਾ ਦਾ ਕਿੱਥੇ ਕਿੱਥੇ ਹੁੰਦੀ ਆ ਇੱਦਾਂ ਹੀ ਮੈਂ ਨਵੀਂ ਨਵੀਂ ਪੰਜਾਬ 'ਚ ਆਈ ਸੀ ਅਤੇ ਮੈਂ ਸੁਣਿਆ ਸੀ ਕਿ ਪੰਜਾਬ ਦੀ ਜਿਹੜੀ ਸ਼ੂਟਿੰਗ ਹੁੰਦੀ ਆ ਉਹ ਵੇਖਣਾ ਬਹੁਤ ਵਧੀਆ ਹੁੰਦਾ ਬਹੁਤ ਨਜ਼ਾਰਾ ਆਉਂਦਾ ਉਨ੍ਹਾਂ ਨੂੰ ਵੇਖ ਕੇ ਹਾਂਜੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਅੱਛਾ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਤਾਂ ਤੁਸੀਂ ਮੈਨੂੰ ਪਤਾ ਕਰਕੇ ਦੱਸ ਦਿਓਗੇ ਕਿੱਥੇ ਕਿੱਥੇ ਸ਼ੂਟਿੰਗ ਹੁੰਦੀ ਹੈ ਹਾਂਜੀ ਹਾਂਜੀ ਚਲੋ ਚੰਗਾ ਫਿਰ ਭਾਅ ਜੀ ਓਕੇ ਬਾਏ